ਪੰਜਾਬ ਵਿੱਚ ਕਾਰੋਬਾਰਾਂ ਲਈ ਮੁੱਖ ਮੌਕੇ ਬਥੇਰੇ ਹਨ ਜਿੱਦਾਂ ਫੈਸ਼ਨ ਡਿਜ਼ਾਇਨ ਹੋ ਗਿਆ ਜਿੱਦਾਂ ਹੈਂਡਲੂਮ ਜਿਹਨੂੰ ਕਹਿੰਦੇ ਹਨ ਲੋਕ ਚੀਜ਼ਾਂ ਬੁਣਨ ਬੁਣਨਾ ਅਤੇ ਦੂਜੇ ਲੋਕਾਂ ਵਾਸਤੇ ਫਟਲਾਇਜ਼ਰ ਕੱਢਣਾ ਤੀਜੀਆਂ ਚੀ ਦੂਜਿਆਂ ਲੋਕਾਂ ਵਾਸਤੇ ਫਟ ਫਟਲਾਇਜ਼ਰ ਬਣਾ ਕੇ ਤਾਂ ਕਿ ਉਹਨਾਂ ਦੀਆਂ ਫਸਲਾਂ ਉੱਗਣ ਨਾਲ ਵਧੀਆ ਵਧੀਆ ਜਾਵਣ ਅਤੇ ਉਹਨਾਂ ਵਾਸਤੇ ਫਟਲਾਇਜ਼ਰ ਬਣਾਉਣ ਦੀ ਇੱਕ ਇੰਡਸਟਰੀ ਬਣ ਜਾਂਦੀ ਹੈਗੀ ਉਹਨਾਂ ਵਾਸਤੇ ਮਸ਼ੀਨਾਂ ਲੱਗਦੀਆਂ ਉਹਦੇ ਵਾਸਤੇ ਬਥੇਰੀਆਂ ਚੀਜ਼ਾਂ ਲੱਗਦੀਆਂ ਹੈ ਜਿਹਦੇ ਨਾਲ ਸਾਨੂੰ ਵੀ ਇੱਕ ਵੱਖ ਜਿਹਾ ਪ੍ਰੋਫਿਟ ਹੁੰਦਾ ਵਾ ਅਤੇ ਦੂਜੀਆਂ ਕੰਪ ਦੂਜੀਆਂ ਕੰਪਨੀਆਂ ਨੂੰ ਵੀ ਉਹਦਾ ਫਾਇਦਾ ਹੁੰਦਾ ਵਾ ਤਾਂ ਕਿ ਉਹ ਆਪਣੀਆਂ ਹੋਰ ਅੱਗੇ ਚੀਜ਼ਾਂ ਬਣਾ ਸਕੇ ਜਿੱਦਾਂ ਲੋਕਾਂ ਨੇ ਆਪਣੀਆਂ ਫਸਲਾਂ ਵਾਸਤੇ ਸਾਡਾ ਫਟਲਾਇਜ਼ਰ ਯੂਜ਼ ਕੀਤਾ ਅਤੇ ਨਾਲੇ ਉਹ ਅੱਗੇ ਜਾ ਕੇ ਉਹ ਨਾ ਫਟਲਾਇਜ਼ਰ ਯੂਜ਼ ਕਰਕੇ ਸਬਜ਼ੀਆਂ ਨਿਕਲਣ ਤੋਂ ਉਹਨਾਂ ਚੀਜ਼ਾਂ ਨੂੰ ਅੱਗੇ ਵੇਚਣਾ ਸਾਡਾ ਤਾਂ ਫਟਲਾਇਜ਼ਰ ਗਿਆ ਉਹਨਾਂ ਦਾ ਅੱਗੇ ਸਬਜ਼ੀਆਂ ਚੱਲ ਗਈਆਂ ਸਾਨੂੰ ਵੀ ਪੈਸਾ ਆ ਗਿਆ ਉਹਨਾਂ ਨੂੰ ਵੀ ਪੈਸਾ ਆ ਗਿਆ ਇੱਦਾਂ ਕਰਕੇ ਬਥੇਰੇ ਮੌਕੇ ਹੈਗੇ ਸਾਡੇ ਕੋਲ ਫੈਸ਼ਨ ਡਿਜ਼ਾਇਨ ਵਿੱਚ ਅਸ ਜਿੱਦਾਂ ਸਾਡੀਆਂ ਕਲਾਵਾਂ ਹੈਗੀਆਂ ਜਿੱਦਾਂ ਸਾਡਾ ਸੱਭਿਆਚਾਰਾਂ ਵਿੱਚ ਬਣਾਏ ਜਾਣ ਵਾਲੇ ਸੂਟ ਵਗੈਰਾ ਹੈਗੇ ਸ ਸੂਟ ਹੈਗੇ ਸੂਟ ਸਲਵਾਰ ਹੋ ਗਏ ਪੰਜਾਬੀ ਜੁੱਤੀਆਂ ਹੋ ਗਏ ਕਿੱਦਾਂ ਸਾਨੂੰ ਕੀ ਆ ਸਾਡਾ ਮੇਕਅਪ ਕਿੱਦਾਂ ਹੁੰਦਾ ਵਾ ਕੁੜੀਆਂ ਦਾ ਅਤੇ ਉਹਨਾਂ ਦੇ ਵਾਲ ਕਿੱਦਾਂ ਬਣਾਏ ਜਾਂਦੇ ਹਨ ਉਹਨਾਂ ਵਾਸਤੇ ਬਥੇਰੀਆਂ ਚੀਜ਼ਾਂ ਅ ਬਣਾ ਸਕਦੇ ਹਾਂ ਅਸੀਂ ਜਿਵੇਂ ਰਿਬਨ ਹੋ ਗਏ ਜਿਵੇਂ ਕੀ ਕਹਿੰਦੇ ਆ ਸਿਰ 'ਤੇ ਪਾਉਣ ਵਾਲੀਆਂ ਮਾਲਾਵਾਂ ਅਤੇ ਗਲਾਂ ਵਿੱਚ ਪਾਉਣ ਵਾਲੇ ਹਾਰ ਵਗੈਰਾ ਜਾਂ ਸੂਟ ਸਲਵਾਰ ਵਗੈਰਾ ਸਿਲਣਾ ਉਹਨਾਂ ਵਾਸਤੇ ਵੱਖਰੇ ਵੱਖਰੇ ਡਿਜ਼ਾਇਨ ਬਣਾਉਣਾ ਜਾਂ ਫਿਰ ਜਿਵੇਂ ਜਿਵੇਂ ਪੰਜਾਬੀ ਜੁੱਤੀ ਹੋ ਗਈ ਪੰਜਾਬੀ ਜੁੱਤੀਆਂ ਵਿੱਚ ਬਥੇਰੇ ਡਿਜ਼ਾਇਨ ਆ ਜਾਂਦੇ ਹਨ ਨੋਰਮਲ ਇੱਦਾਂ ਵੱਖ ਫਰਕ ਫਰਕ ਵੇਖਣਾ ਵੀ ਆਸਾਨ ਹੋ ਜਾਂਦਾ ਵਾ ਅਤੇ ਜਿ ਜਿੰਨੀਆਂ ਜ਼ਿਆਦਾ ਉਹ ਹੋਣ ਕੀ ਹੈ ਚੀਜ਼ਾਂ ਹੋਣ ਓਨੀਆਂ ਓਨੀਆਂ ਵਧੀਆ ਅਤੇ ਪੰਜਾਬ ਵਿੱਚ ਕਾਰੋਬਾਰਾਂ ਦੇ ਕਦੀ ਕਮੀ ਨਹੀਂ ਆਈ ਅਤੇ ਨਾ ਕਦੇ ਹੋਣੀ ਅਤੇ ਜਿਵੇਂ ਹੋਰ ਕਾਰੋਬਾਰ ਆਉਂਦੇ ਆ ਜਿਵੇਂ ਇੱਕ ਲੋਕਾਂ ਨੂੰ ਬਾ ਪੰਜਾਬ ਵਿੱਚ ਬਾਹਰ ਜਾਣ ਦਾ ਬੜਾ ਸ਼ੌਕ ਹੁੰਦਾ ਵਾ ਤਾਂ ਉਹਨਾਂ ਵਾਸਤੇ ਆਇਲਸ ਦੀ ਕੋਚਿੰਗ ਸੈਂਟਰ ਬਣਾ ਦੇਣੇ ਉਹਨਾਂ ਵਾਸਤੇ ਹੋਰ ਚੀਜ਼ਾਂ ਕਰ ਦੇਣੀਆਂ ਲੋਕ ਆਇਲਸ ਪੜ੍ਹਾ ਪਹਿਲਾਂ ਪੜ੍ਹਦੇ ਹਨ ਅਤੇ ਅੱਗੇ ਹੁਣ ਫਿਰ ਪੜ੍ਹਾਉਂਦੇ ਵੀ ਹਨ ਅਤੇ ਇੱਦਾਂ ਦੀ ਬਥੇਰੀਆਂ ਚੀਜ਼ਾਂ ਹੁੰਦੀਆਂ ਜਿਹੜੇ ਪੰਜਾਬੀ ਲੋਕ ਕਰਦੇ ਹਨ ਅਤੇ ਜੇ ਜਿਹੜੀ ਚੀਜ਼ਾਂ ਬਾਕੀਆਂ ਨੂੰ ਵੀ ਹੈਲਪ ਕਰਦੀਆਂ ਹਨ ਅਤੇ ਸਾਨ ਸਾਨੂੰ ਵੀ ਇੱਕ ਵਧੀਆ ਜਿਹਾ ਪ੍ਰੋਫਿਟ ਦਿੰਦੀਆਂ ਅਤੇ ਸਾਡਾ ਕੀ ਹੈ ਕਲਚਰ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਂਦੀਆਂ ਵੀ ਹੈਗੀਆਂ ਥੈਂਕ ਯੂ